ਪੰਜ ਮਾਰਚ ਉੱਨੀ ਵੀਹ ਅੱਠ ਮਈ ਉੱਨੀ ਅਠੱਤਰ ਤੇਰ੍ਹਾਂ ਜਨਵਰੀ ਵੀਹ ਇੱਕੀ ਸਤਾਰਾਂ ਫ਼ਰਵਰੀ ਅਠਾਰਾਂ ਉੱਨੀ ਅਠਾਰਾਂ ਦਸੰਬਰ ਪੰਦਰਾਂ ਛਿਹੱਤਰ